ਕਰਿਸਚਨ ਰੋਨਾਲਡੋ ਪੁਰਤਗਾਲ ਦਾ ਫੁਟਬੋਲਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਘੂਲ ਪੰਜਾਬ ਦਾ ਪੰਜਾਬੀ ਐਕਟਰ ਸਚਿਨ ਤੰਦੂਲਕਰ ਪੰਜਾਬ ਦਾ ਕ੍ਰਿਕਟਰ ਸਲਮਾਨ ਖਾਨ ਭਾਰਤ ਦਾ ਹਿੰਦੀ ਐਕਟਰ